ਅੱਜ ਦੇ ਸਮੇਂ ਵਿੱਚ ਜੋ ਕਿ ਇੱਕ ਲੇਡੀਜ ਲਈ ਵਧੀਆ ਰੁਜ਼ਗਾਰ ਹੈ ਜੋ ਕਿ ਉਸ ਦੇ ਲਈ ਸਿਲਾਈ ਹੈ ਅਤੇ ਉਹ ਆਪਣੀ ਸਿਲਾਈ ਆਪਦੇ ਹੱਥੀਂ ਬਣਿਆ ਹੀ ਸੂਟ ਉਸਨੂੰ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਜੋ ਉਸ ਵਿੱਚ ਕਈ ਤਰ੍ਹਾਂ ਦੇ ਡਿਜ਼ਾਇਨ ਸਟਿਚ ਕਰ ਸਕਦੀ ਹੈ ਕਈ ਤਰ੍ਹਾਂ ਦੇ ਕ ਡਿਜਾਇਨ ਤੌਰ 'ਤੇ ਕੱਪੜੇ ਬਣਾ ਸਕਦੀ ਹੈ ਜੋ ਰੈਡੀਮੈਂਟ ਕੱਪੜੇ ਆ ਉਹਨਾਂ ਵਿੱਚ ਘੱਟ ਹੀ ਡਿਜ਼ਾਇਨ ਹੁੰਦਾ ਹੈ ਅਤੇ ਉਹਨਾਂ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਰੇਡੀਮੈਂਟ ਕੱਪੜੇ ਜੋ ਕਿ ਸਾਨੂੰ ਕੋਈ ਕੋਈ ਵਧੀਆ ਢੰਗ ਨਾਲ ਮਿਲ ਲੈ ਕੋਈ ਕੋਈ ਪਸੰਦ ਆਉਂਦਾ ਹੈ ਅਤੇ ਕੋਈ ਕੋਈ ਨਹੀਂ ਇਸੇ ਲਈ ਸਾਨੂੰ ਆਪਣੇ ਹੱਥੀਂ ਬਣਿਆ ਸਿਲਾਈ ਕੀਤਾ ਕੰਮ ਵਧੀਆ ਹੀ ਦੇਖਣ ਨੂੰ ਮਿਲਦਾ ਹੈ ਉਸ ਨਾਲ ਸਾਨੂੰ ਜੋ ਕਿ ਵਧੀਆ ਡਿਜ਼ਾਈਨਿੰਗ ਤਿਆਰ ਹੁੰਦੀ ਹੈ ਜੋ ਵੀ ਸਾਨੂੰ ਪਸੰਦ ਹੋਵੇ ਇਸ ਨਾਲ ਕੱਪੜੇ ਦੀ ਬੁਣਾਈ ਵੀ ਬਹੁਤ ਅੱਛੇ ਢੰਗ ਨਾਲ ਕੀਤੀ ਜਾਂਦੀ ਹੈ ਅਤੇ ਇਸ ਕੱਪੜੇ ਵਿੱਚ ਜੋ ਵੀ ਸਾਨੂੰ ਕੋਈ ਵਧੀਆ ਰੰਗ ਕਢਾਈ ਸਲਾਈ ਕਰ ਸਕਦੇ ਹੈ ਅਤੇ ਸਾਡੇ ਸਰੀਰ ਦੇ ਅਕੋਰਡਿੰਗ ਅਸੀਂ ਉਸ ਨੂੰ ਤਿਆਰ ਕਰ ਸਕਦੇ ਆ ਰੇਡੀਮੈਂਟ ਕੱਪੜੇ 'ਚ ਕੋਈ ਖੁੱਲ੍ਹਾ ਕੋਈ ਸਿਲਾਈ ਉਧੜੀ ਹੁੰਦੀ ਹੈ ਉਸ ਨਾ ਸਾਨੂੰ ਜੋ ਕਿ ਅੱਛਾ ਨਹੀਂ ਲੱਗਦਾ